ਕਿਤਾਬ ਨੂੰ ਪੜ੍ਹਨਾ ਅਤੇ ਕਿਤਾਬ ਨੂੰ ਕਿੰਨੇ ਸਮੇਂ 'ਚ ਪੂਰਾ ਕਰਨਾ ਇਹ ਸਭ ਕਿਤਾਬ 'ਤੇ ਨਿਰਭਰ ਹੁੰਦਾ ਹੈ ਕੁਝ ਕਿਤਾਬਾਂ ਵਿੱਚ ਕਹਾਣੀਆਂ ਦਿੱਤੀ ਗਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੜ੍ਹਨ ਦੇ ਵਿੱਚ ਬਹੁਤ ਹੀ ਮਨ ਲੱਗਦਾ ਹੈ ਕਿਤਾਬਾਂ ਗਿਆਨ ਨੂੰ ਸੰਜੋਅ ਕੇ ਰੱਖਣ ਦਾ ਬਹੁਤ ਵਧੀਆ ਸਾਧਨ ਹਨ ਜਿਹੜੀ ਗੱਲ ਕਿਸੇ ਕਿਤਾਬ ਤੋਂ ਅਸੀਂ ਪੜ੍ਹ ਲਈ ਉਹ ਜ਼ਿੰਦਗੀ ਭਰ ਸਾਨੂੰ ਯਾਦ ਰਹਿੰਦੀ ਹੈ ਜੇ ਕਿਤੇ ਭੁੱਲ ਵੀ ਜਾਈਏ ਤਾਂ ਝੱਟ ਉਹ ਕਿਤਾਬ ਖੋਲ੍ਹੀ ਅਤੇ ਦੁਬਾਰਾ ਪੜ੍ਹ ਕੇ ਫਿਰ ਯਾਦ ਕਰ ਲੈਂਦੇ ਹਾਂ ਹਰ ਕਿਤਾਬ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਦਿੰਦੀ ਹੈ ਜਦੋਂ ਅਸੀਂ ਕੋਈ ਕਿਤਾਬ ਪੜ੍ਹਦੇ ਹਾਂ ਤਾਂ ਇਸ ਨਾਲ ਸਾਨੂੰ ਕਈ ਨਵੀਆਂ ਗੱਲਾਂ ਪਤਾ ਲੱਗਦੀਆਂ ਹਨ ਜਿਸ ਨਾਲ ਸਾਡੇ ਗਿਆਨ ਦਾ ਭੰਡਾਰ ਵੱਧਦਾ ਹੈ ਇਸ ਨਾਲ ਤੁਸੀਂ ਉਹ ਕੁਝ ਹਾਸਲ ਕਰ ਸਕਦੇ ਹੋ ਜੋ ਕਈਆਂ ਦੇ ਹੱਥ 'ਚ ਨਹੀਂ ਹੁੰਦਾ ਤੁਹਾਡੇ ਕੋਲੋਂ ਕੋਈ ਮਨੁੱਖ ਤੁਹਾਡੀ ਸੰਪਤੀ ਖੋ ਸਕਦਾ ਹੈ ਪਰ ਕਿਤਾਬਾਂ ਤੋਂ ਪ੍ਰਾਪਤ ਕੀਤਾ ਗਿਆਨ ਕਦੇ ਵੀ ਨਹੀਂ ਖੋ ਸਕਦਾ ਜਿੰਨੀਆਂ ਜ਼ਿਆਦਾ ਕਿਤਾਬਾਂ ਪੜ੍ਹਾਂਗੇ ਅਸੀਂ ਓਨਾ ਹੀ ਸਾਨੂੰ ਗਿਆਨ ਵਧੇਗਾ ਓਨਾ ਹੀ ਸਾਡਾ ਉਸ ਕਿਤਾਬ ਦੀ ਭਾਸ਼ਾ ਅਤੇ ਸ਼ਬਦਾਂ ਦਾ ਗਿਆਨ ਵਧੇਗਾ ਜਿਸ ਨਾਲ ਅਸੀਂ ਉਸ ਭਾਸ਼ਾ ਨੂੰ ਮਹਾਰਤ ਹਾਸਲ ਕਰ ਸਕਾਂਗੇ